ਸਰਕਾਰ ਔਰਤਾਂ ਲਈ ਉੱਚ ਸਿੱਖਿਆ ਦੇ ਮੌਕੇ ਉਪਲਬਧ ਕਰਨ ਲਈ ਬਹੁਤ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਉਹ ਔਰਤਾਂ ਨੂੰ ਉੱਚ ਸਿੱਖਿਆ ਦੇਣ ਲਈ ਕਈ ਤਰ੍ਹਾਂ ਦੇ ਸਿਰਫ ਔਰਤਾਂ ਲਈ ਸਰਕਾਰੀ ਸਕੂਲ ਸਰਕਾਰੀ ਕੋਲਜ ਬਣਾ ਰਹੀ ਹੈ ਉਹ ਸਰਕਾਰੀ ਕੋਲਜਾਂ ਵਿੱਚ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਕਈ ਤਰ੍ਹਾਂ ਦੇ ਟੀਚਰਜ ਰੱਖੇ ਹਨ ਜਿਸ ਕਰਕੇ ਔਰਤਾਂ ਨੂੰ ਉੱਚ ਸਿੱਖਿਆ ਪ੍ਰਾਪਤ ਹੋਵੇ ਸਰਕਾਰ ਨੇ ਔਰਤਾਂ ਲਈ ਸਿਹਤ ਸੁਰੱਖਿਆ ਸੰਬੰਧੀ ਕਈ ਤਰ੍ਹਾਂ ਦੀ ਸਹੂਲਤਾਂ ਉਪਲਬਧ ਕਰਵਾਈਆਂ ਹਨ ਜਿਹਨਾਂ ਵਿੱਚ ਜੇਕਰ ਕੋਈ ਵੀ ਔਰਤ ਨਾਲ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਉਸ ਨੂੰ ਇੱਕ ਨੰਬਰ ਦਿੱਤਾ ਜਾਂਦਾ ਹੈ ਜੋ ਸਿਰਫ ਔਰਤਾਂ ਲਈ ਹੁੰਦਾ ਹੈ ਜਿਸ ਦਾ ਨੰਬਰ ਦਸ ਅਠਾਨਵੇਂ ਹੈ ਇਹ ਨੰਬਰ ਰਾਹੀਂ ਜੇਕਰ ਕੋਈ ਵੀ ਵਿਅਕਤੀ ਔਰਤ ਨਾਲ ਛੇੜਖਾਨੀ ਕਰਦਾ ਹੈ ਤਾਂ ਉਹ ਇਸ ਨੰਬਰ 'ਤੇ ਫੋਨ ਕਰੇ ਅਤੇ ਆਪਣੀ ਲੋਕੇਸ਼ਨ ਦੱਸੇ ਫਿਰ ਪੁਲਿਸ ਉਸਦੀ ਲੋਕੇਸ਼ਨ ਟ੍ਰਾਂਸਫਰ ਕਰਕੇ ਉਸ ਕੋਲ ਪਹੁੰਚਦੀ ਹੈ ਅਤੇ ਉਸ ਦੀ ਸੁਰੱਖਿਆ ਕਰਦੀ ਹੈ ਇਹ ਨੰਬਰ 'ਤੇ ਕਾਲ ਕਰਕੇ ਔਰਤ ਆਪਣੇ ਆਪ ਨੂੰ ਮਜ਼ਬੂਤ ਸਮਝਦੀ ਹੈ ਜਿਸ ਕਰਕੇ ਸਰਕਾਰ ਨੇ ਇਹ ਨੰਬਰ ਦੀ ਉਤਪਤੀ ਕੀਤੀ ਹੁਣ ਪੰਜਾਬ ਵਿੱਚ ਔਰਤਾਂ ਮੁੰਡਿਆਂ ਦੇ ਬਰਾਬਰ ਹੋ ਚੁੱਕੀਆਂ ਹਨ ਜਿਸ ਕਰਕੇ ਉੱਚ ਸਿੱਖਿਆ ਬਹੁਤ ਹੀ ਜ਼ਿਆਦਾ ਵੱਧ ਚੁੱਕੀ